ਹੁਣ ਤੱਕ ਦੀ ਮੇਰੀ ਸਭ ਤੋਂ ਸੁੰਦਰ ਯਾਤਰਾ ਹੈ ਜਗਨਨਾਥ ਪੁਰੀ ਦੀ ਜਗਨਨਾਥ ਪੁਰੀ ਇੱਕ ਇਹੋ ਜਿਹਾ ਮੰਦਰ ਹੈ ਜਿਸਨੂੰ ਭਗਵਾਨ ਉੱਥੇ ਭਗਵਾਨ ਕ੍ਰਿਸ਼ਨ ਦੀ ਦੀ ਸਭ ਤੋਂ ਵੱਡੀ ਮੂਰਤੀ ਬਣੀ ਹੋਈ ਹੈ ਜਗਨਨਾਥ ਪੁਰੀ ਦੇ ਵਿੱਚ ਮੈਂ ਯਾਤਰਾ ਕੀਤੀ ਅਤੇ ਪਹਿਲਾਂ ਤਾਂ ਮੈਂ ਇੱਥੋਂ ਮੈਂ ਅਸੀਂ ਇੱਥੋਂ ਟਰੇਨ ਰਾਹੀਂ ਗਏ ਫਿਰ ਉੱਥੇ ਹਵਾਈ ਜ਼ਾਹਜ ਰਾਹੀਂ ਅਸੀਂ ਉੱਥੇ ਭੁਵਨੇਸ਼ਵਰ ਪਹੁੰਚੇ ਅਤੇ ਫਿਰ ਉਸ ਤੋਂ ਬਾਅਦ ਅਸੀਂ ਟੈਕਸੀ ਰਾਹੀਂ ਜਗਨਨਾਥ ਪੁਰੀ ਗਏ ਉੱਥੇ ਭਗਵਾਨ ਦੀ ਰੱਥ ਯਾਤਰਾ ਨਿਕਲਦੀ ਹੈ ਜਿਹੜੀ ਬਹੁਤ ਹੀ ਚੰਗੀ ਮੰਨੀ ਜਾਂਦੀ ਅਤੇ ਉੱਥੇ ਸਾਰੇ ਉਸਨੂੰ ਕੰਧਾ ਦਿੰਦੇ ਹਨ ਸਾਰੇ ਉਹਨਾਂ ਨੂੰ ਯਾਤਰਾ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਮੈਂ ਵੀ ਜਗਨਨਾਥ ਪੁਰੀ ਦੀ ਯਾਤਰਾ ਕੀਤੀ ਉੱਥੇ ਸਮੁੰਦਰ ਵੀ ਹੈ ਜਿਹੜਾ ਸਮੁੰਦਰ ਆ ਨਜ਼ਾਰਾ ਉਹ ਬਹੁਤ ਹੀ ਸੋਹਣਾ ਹੈ ਉਸ ਬਾਰੇ ਜਦੋਂ ਸੂਰਜ ਨਿਕਲਦਾ ਹੈ ਉੱਥੇ ਇੱਕ ਕੋਕਾਂਗ ਟੈਂਪਲ ਵੀ ਹੈ ਮੰਦਰ ਹੈ ਜਿਹੜਾ ਉਹ ਉੱਥੇ ਸੂਰਜ ਸਭ ਤੋਂ ਪਹਿਲਾਂ ਹੀ ਨਿਕਲਦਾ ਹੈ ਸਭ ਤੋਂ ਪਹਿਲਾਂ ਸੂਰਜ ਦੀ ਕਿਰਨ ਉਹਦੇ ਉੱਤ ਮੰਦਰ ਦੇ ਉੱਤੇ ਹੀ ਜਾ ਕੇ ਪੈਂਦੀ ਹੈ ਉੱਥੇ ਬੜੇ ਸਨ ਟੈਂਪਲ ਹੈ ਜਿੱਥੇ ਉੱਥੇ ਜਾ ਕੇ ਮੰਦਰ ਦੀ ਸਭ ਤੋਂ ਪਹਿਲੀ ਕਿਰਨ ਉੱਥੇ ਪੈਂਦੀ ਹੈ ਅਤੇ ਲੋਕ ਬੜੇ ਲੋਕੀ ਦੂਰੋਂ ਦੂਰੋਂ ਉਸ ਨੂੰ ਜਦੋਂ ਮੰਦਰ ਨੂੰ ਦੇਖਣ ਆਉਂਦੇ ਹਨ ਉੱਥੇ ਸਭ ਤੋਂ ਪਹਿਲਾਂ ਸੂਰਜ ਦੀ ਕਿਰਨ ਪੈਂਦੀ ਵੀ ਹੈ ਅਤੇ ਸੂਰਜ ਤੋਂ ਛਿਪਦਾ ਵੀ ਸਭ ਤੋਂ ਪਹਿਲਾਂ ਹੈ ਉਸ ਮੰਦਰ ਦੀ ਯਾਤਰਾ ਕਰਕੇ ਫਿਰ ਮੈਂ ਉੱਥੇ ਜਗਨਨਾਥ ਪੁਰੀ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਅਤੇ ਉੱਥੇ ਸੁਦਾਮਾ ਜੀ ਯਸ਼ੋਧਾ ਜੀ ਦੀ ਮੂਰਤੀ ਲੱਗੀ ਹੋਈ ਸੀ ਅਤੇ ਮੈਂ ਉੱਥੋਂ ਦੀ ਯਾਤਰਾ ਕਰਕੇ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਾ